ਮੀਡੀਆ ਰੇਡੀਓ ਟੈਲੀਵਿਜ਼ਨ ਅਤੇ ਪ੍ਰਿੰਟ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਅੱਜ ਆਧੁਨਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਦਾ ਰੂਪ ਹੌਲੀ ਹੌਲੀ ਬਦਲ ਰਿਹਾ ਹੈ ਇਸ ਵਿੱਚ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਮਿੱਕਸ ਹੋ ਚੁੱਕੇ ਹਨ ਕੁਝ ਸ਼ਬਦ ਤਾਂ ਅਜਿਹੇ ਹਨ ਜਿਨ੍ਹਾਂ ਦਾ ਸਾਨੂੰ ਪੰਜਾਬੀ ਵਿੱਚ ਮਤਲਬ ਵੀ ਨਹੀਂ ਪਤਾ ਸਾਨੂੰ ਉਹ ਅੰਗਰੇਜ਼ੀ ਵਿੱਚ ਹੀ ਪਤਾ ਹੈ ਅਤੇ ਸਾਨੂੰ ਉਹ ਪੰਜਾਬੀ ਸ਼ਬਦ ਲੱਗਦੇ ਹਨ ਟੈਲੀਵਿਜ਼ਨ 'ਤੇ ਵਿਖਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਵੀ ਅੱਜ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਮਿਲੀ ਜੁਲੀ ਬੋਲੀ ਜਾਂਦੀ ਹੈ ਸਾਨੂੰ ਸ਼ੁੱਧ ਪੰਜਾਬੀ ਨਹੀਂ ਆਉਂਦੀ